ਹਾਂ ਮੈਂ ਪਹਿਲਾਂ ਟਰੈਕਿੰਗ ਸਾਈਟਾਂ 'ਤੇ ਪਹਿਲਾਂ ਨਾਲੋਂ ਜ਼ਿਆਦਾ ਕੂੜਾ ਕਰਕਟ ਦੇਖਿਆ ਪਹਿਲਾਂ ਵੀ ਬਹੁਤ ਕੂੜਾ ਹੁੰਦਾ ਸੀ ਜਿਹੜੇ ਲੋਕ ਨੇ ਕੁਝ ਖਾਂਦੇ ਪੀਂਦੇ ਆ ਸਫ਼ਰ ਦੇ ਦੌਰਾਨ ਉਹਦੇ ਛਿਲਕੇ ਹੈ ਨਾ ਰੈਪਰ ਸਾਰਾ ਕੁਛ ਕੀ ਹੈ ਐਵੇਂ ਹੀ ਸੁੱਟ ਦਿੰਦੇ ਹੈ ਹਾਲਾਂਕਿ ਸਾਰੇ ਸਟੇਸ਼ਨ 'ਤੇ ਬੱਸ ਸਟੋਪ 'ਤੇ ਸਾਰੇ ਕਿਤੇ ਕੀ ਹੈ ਡਸਟਬੀਨ ਹੁੰਦੇ ਨੇ ਪਰ ਲੋਕ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ ਲੋਕ ਇਸ ਚੀਜ਼ ਦਾ ਧਿਆਨ ਸਿਰਫ ਆਪਣੀ ਘਰ ਦੀ ਸਫਾਈ ਵਿੱਚ ਦੇਖਦੇ ਹੈ ਘਰਾਂ 'ਚ ਸਫਾਈ ਕਰਨਾ ਪਸੰਦ ਕਰਦੇ ਹੈ ਨਾ ਕਿ ਬਾਹਰ ਸਾਫ਼ ਸਫਾਈ ਵਿੱਚ ਧਿਆਨ ਦਿੰਦੇ ਹੈ ਲੋਕ ਕੀ ਕਰਦੇ ਅਸੀਂ ਆਪਾਂ ਸਾਫ਼ ਇਸ ਤਰ੍ਹਾਂ ਕਰ ਸਕਦੇ ਹਾਂ ਵਾਤਾਵਰਨ ਨੂੰ ਕਿ ਪਹਿਲਾਂ ਆਪਾਂ ਨੂੰ ਖੁਦ ਆਪਦੇ ਆਪ ਨੂੰ ਚੇਂਜ ਕਰਨਾ ਚਾਹੀਦਾ ਹੈ ਬਦਲਣਾ ਚਾਹੀਦਾ ਹੈ ਜੇ ਅਸੀਂ ਕਿਤੇ ਸਫ਼ਰ ਦੌਰਾਨ ਕਿਤੇ ਜਾਂਦੇ ਹਾਂ ਕੁਝ ਖਾਂਦੇ ਪੀਂਦੇ ਹਾਂ ਤਾਂ ਸਾਨੂੰ ਉਹ ਸਾਰਾ ਸਮਾਨ ਜਿਹੜਾ ਕੀ ਹੈ ਵੇਸਟ ਕੋਈ ਰੈਪਰ ਹੋ ਗਏ ਜਾਂ ਕੋਈ ਫਰੂਟ ਦੇ ਛਿਲਕੇ ਹੋ ਗਏ ਕੁਛ ਵੀ ਹੁੰਦਾ ਉਹਨੂੰ ਆਪਾਂ ਨੂੰ ਡਸਟਬੀਨ 'ਚ ਸੁੱਟਣਾ ਚਾਹੀਦਾ ਹੈ ਨਾ ਕਿ ਨੀਚੇ ਫਰਸ਼ 'ਤੇ ਜਾਂ ਰੇਲ ਗੱਡੀਆਂ ਵਿੱਚ ਜਾਂ ਬੱਸ ਬੱਸਾਂ ਵਿੱਚ ਸੁੱਟਣਾ ਚਾਹੀਦਾ ਹੈ ਸਾਨੂੰ ਸਾਰਾ ਕੁਛ ਡਸਟਬੀਨ 'ਚ ਸੁੱਟਣਾ ਚਾਹੀਦਾ ਹੈ ਜੇਕਰ ਉੱਥੇ ਡਸਟਬਿਨ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਕੋਲ ਰੱਖ ਲੈਣਾ ਚਾਹੀਦਾ ਹੈ ਅਤੇ ਸਾਨੂੰ ਬਾਅਦ 'ਚੋਂ ਘਰ ਜਾ ਕੇ ਡਸਟਬਿਨ 'ਚ ਸੁੱਟਣਾ ਚਾਹੀਦਾ ਹੈ ਅਤੇ ਸਾਨੂੰ ਇਹ ਸਾਰਾ ਕੁਛ ਲੋਕਾਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਸਾਨੂੰ ਵਾਤਾਵਰਨ 'ਚ ਗੰਦ ਨਹੀਂ ਪਾਉਣਾ ਚਾਹੀਦਾ ਜੇ ਅਸੀਂ ਇੱਦਾਂ ਕਰਾਂਗੇ ਤਾਂ ਸਾਰਾ ਕੁਛ ਕੀ ਹੈ ਵਾਤਾਵਰਨ ਖ਼ਰਾਬ ਹੋ ਜਾਊਗਾ ਜਿਹਦੇ ਨਾਲ ਕਿ ਸਾਨੂੰ ਅਲੱਗ ਅਲੱਗ ਬਿਮਾਰੀਆਂ ਲੱਗ ਸਕਦੀਆਂ ਜਿਹਦੇ ਵਿੱਚ ਸਾਡਾ ਹੀ ਨੁਕਸਾਨ ਹੈ ਨਾ ਕਿ ਕਿਸੇ ਹੋਰ ਦਾ ਇਸ ਲਈ ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੀਦਾ ਕੂੜਾ ਕਰਕਟ ਬਾਹਰ ਨਹੀਂ ਸੁੱਟਣਾ ਚਾਹੀਦਾ ਸਾਨੂੰ ਉਸ ਨੂੰ ਡਸਟਬਿਨ 'ਚ ਹੀ ਸੁੱਟਣਾ ਚਾਹੀਦਾ